ਪੰਜਾਬ ਦੀਆਂ ਮਿਠਾਈਆਂ ਵਿੱਚ ਜਲੇਬੀ ਸਭ ਤੋਂ ਮਸ਼ਹੂਰ ਹੈ ਪੰਜਾਬ ਵਿੱਚ ਕੋਈ ਵੀ ਵਿਆਹ ਹੋਵੇ ਤਾਂ ਉਸ ਵਿੱਚ ਜਲੇਬੀਆਂ ਜ਼ਰੂਰ ਬਣਾਈਆਂ ਜਾਂਦੀਆਂ ਹਨ ਇਸ ਤੋਂ ਬਿਨਾਂ ਜੇ ਪੰਜਾਬ ਵਿੱਚ ਕਿਸੇ ਬਜ਼ੁਰਗ ਦੀ ਜ਼ਿਆਦਾ ਉਮਰ ਵਿੱਚ ਮੌਤ ਹੋਵੇ ਭਾਵ ਕੋਈ ਸੌ ਸਾਲ ਤੋਂ ਉੱਪਰ ਦੀ ਉਮਰ ਦਾ ਮਰਦਾ ਹੈ ਉਸਦੇ ਭੋਗ ਉੱਪਰ ਜਲੇਬੀਆਂ ਬਣਾਈਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਪੰਜਾਬ ਵਿੱਚ ਬਹੁਤ ਸਾਰੇ ਮੇਲੇ ਲੱਗਦੇ ਹਨ ਹਰੇਕ ਮੇਲੇ ਵਿੱਚ ਜਲੇਬੀਆਂ ਦੀ ਦੁਕਾਨ ਜ਼ਰੂਰ ਹੋਵੇਗੀ ਚਾਹੇ ਉਹ ਸਰਦੀਆਂ ਦਾ ਮੌਸਮ ਹੋਵੇ ਚਾਹੇ ਗਰਮੀ ਦਾ ਮੌਸਮ ਜਲੇਬੀ ਤੁਹਾਨੂੰ ਹਰ ਮੌਸਮ ਵਿੱਚ ਮਿਲ ਜਾਵੇਗੀ ਸਰਦੀਆਂ ਦੇ ਮੌਸਮ ਵਿੱਚ ਪੰਜਾਬ ਦੇ ਲੋਕ ਘਰਾਂ ਵਿੱਚ ਦੁੱਧ ਕਾੜ ਕੇ ਉਸ ਤੋਂ ਖੋਆ ਤਿਆਰ ਕਰਦੇ ਹਨ ਇਸ ਵਿੱਚ ਬਹੁਤ ਸਾਰੇ ਮੇਵੇ ਪਾਏ ਜਾਂਦੇ ਹਨ ਜਿਵੇਂ ਕਾਜੂ ਬਦਾਮ ਪਿਸਤੇ ਆਦਿ ਫਿਰ ਇਸ ਦੀਆਂ ਪਿੰਨੀਆਂ ਬਣਾ ਲਈਆਂ ਜਾਂਦੀਆਂ ਹਨ ਅਤੇ ਸਾਰਾ ਸਰਦੀ ਦੇ ਮਹੀਨਿਆਂ ਵਿੱਚ ਇਸ ਨੂੰ ਖਾਂਦੇ ਹਨ